ਮੈਨੂੰ ਸਭ ਤੋਂ ਵੱਧ ਸੱਭਿਆਚਾਰਕ ਡਾਂਸ ਪਸੰਦ ਹੈ ਇਨ੍ਹਾਂ ਵਿੱਚ ਸਭ ਤੋਂ ਵੱਧ ਮੈਨੂੰ ਗਿੱਧਾ ਵਧੀਆ ਲੱਗਦਾ ਹੈ ਗਿੱਧਾ ਇਸ ਲਈ ਵਧੀਆ ਲੱਗਦਾ ਕਿਉਂਕਿ ਮੈਂ ਛੋਟੇ ਹੁੰਦੇ ਤੋਂ ਹੀ ਇਹ ਡਾਂਸ ਕਰਦੀ ਆ ਰਹੀ ਹਾਂ ਇਸ ਵਿੱਚ ਆਪਾਂ ਅਲੱਗ ਹੀ ਤਰੀਕੇ ਨਾਲ ਤਿਆਰ ਹੁੰਦੇ ਹਾਂ ਸੱਭਿਆਚਾਰਕ ਭਾਵਨਾਵਾਂ ਨਾਲ ਆਪਾਂ ਇਹ ਡਾਂਸ ਪੇਸ਼ ਕਰਦੇ ਹਾਂ ਜਿਸ ਨਾਲ ਲੋਕ ਕੀ ਹੈ ਕਿ ਸੱਭਿਆਚਾਰਕ ਨਾਚ ਨਾਲ ਜੁੜ ਜਾਂਦੇ ਹਨ ਜਿਨ੍ਹਾਂ ਲੋਕਾਂ ਨੂੰ ਇਸ ਡਾਂਸ ਦੀ ਜਾਣਕਾਰੀ ਨਹੀਂ ਹੁੰਦੀ ਉਹ ਵੀ ਇਸ ਵੱਲ ਆਕਰਸ਼ਿਤ ਹੋ ਜਾਂਦੇ ਹਨ ਇਸ ਦੇ ਵਿੱਚ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਕੌਸਟੀਊਮ ਪਹਿਨਦੇ ਹਾਂ ਜਿਵੇਂ ਕਿ ਘੱਗਰਾ ਲਹਿੰਗਾ ਜਾਂ ਫਿਰ ਆਪਾਂ ਪੰਜਾਬੀ ਸੂਟ ਵੀ ਪਾ ਸਕਦੇ ਹਨ ਇਸ ਵਿੱਚ ਮੈਨੂੰ ਪਰਾਂਦਾ ਅਤੇ ਚੂੜੀਆਂ ਪਾਉਣ ਦਾ ਬੜਾ ਸ਼ੌਕ ਹੈ ਜੋ ਕਿ ਮੈਂ ਇਸ ਵਿੱਚ ਪਾ ਕੇ ਨਾ ਪਾ ਸਕਦੀ ਹਾਂ ਅਤੇ ਇਹ ਡਾਂਸ ਬਹੁਤ ਹੀ ਮੈਨੂੰ ਵਧੀਆ ਲੱਗਦਾ ਹੈ ਕਿਉਂਕਿ ਇਸ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਬੋਲੀਆਂ ਟੱਪੇ ਸਾਰਾ ਕੁਛ ਆਉਂਦਾ ਹੈ ਜੋ ਕਿ ਮੈਨੂੰ ਬਹੁਤ ਪਸੰਦ ਹਨ ਅਤੇ ਇਹ ਡਾਂਸ ਮੈਂ ਕਈ ਥਾਵਾਂ 'ਤੇ ਜਿਵੇਂ ਕਿ ਯੂਥ ਫੈਸਟੀਵਲ ਕੋਲੇਜ ਟਾਈਮ ਸਕੂਲ ਟਾਈਮ ਕੌਂਪੀਟਿਸ਼ਨਾਂ ਵਿੱਚ ਕਰ ਚੁੱਕੀ ਹਾਂ ਅਤੇ ਜਿਨ੍ਹਾਂ ਵਿੱਚ ਮੈਂ ਜੇਤੂ ਵੀ ਰਹੀ ਹਾਂ ਇਹ ਡਾਂਸ ਮੈਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦਾ ਹੈ ਅਤੇ ਦੂਜੇ ਲੋਕਾਂ ਨੂੰ ਵੀ ਵਿਰਸੇ ਦੀ ਜਾਣਕਾਰੀ ਦਿੰਦਾ ਹੈ ਮੈਂ ਚਾਹੁੰਦੀ ਹਾਂ ਆਉਣ ਵਾਲੀ ਜਨਰੇਸ਼ਨ ਵੀ ਇਸ ਡਾਂਸ ਨੂੰ ਫੋਲੋ ਕਰੇ ਅਤੇ ਵੱਧ ਤੋਂ ਵੱਧ ਇਹ ਡਾਂਸ ਬਾਰੇ ਜਾਣਕਾਰੀ ਪ੍ਰਾਪਤ ਕਰੇ ਤਾਂ ਕਿ ਸਾਡਾ ਲੋਕ ਨਾਚ ਹਮੇਸ਼ਾ ਹੀ ਦੁਨੀਆ ਵਿੱਚ ਚੱਲਦਾ ਰਹੇ ਅਤੇ ਲੋਕ ਇਸ ਨੂੰ ਵੱਧ ਤੋਂ ਵੱਧ ਜਾਨਣ